ਮੇਰੇ ਕੋਲ ਇੱਕ ਕਿਤਾਬ ਸੀ ਜਿਹਦਾ ਨਾਮ ਫਰੀਡਮ ਐਟ ਮਿਡਨਾਈਟ ਸੀਗੀ ਉਹ ਕਿਤਾਬ ਅੰਗਰੇਜ਼ੀ ਦੇ ਵਿੱਚ ਸੀ ਪਰ ਉਹਦੇ ਵਿੱਚ ਜਦ ਭਾਰਤ ਨੇ ਆਜ਼ਾਦੀ ਲਈ ਸੀ ਉਹ ਸਾਰੀ ਘਟਨਾ ਦਿੱਤੀ ਹੋਈ ਹੈ ਕਿ ਕਿੰਨੇ ਵਜੇ ਭਾਰਤ ਆਜ਼ਾਦ ਹੋਇਆ ਅਤੇ ਉਸ ਟਾਈਮ ਉਹਦੇ ਕੀ ਕੀ ਮੇਨ ਈਵੈਂਟਸ ਹੋਈਆਂ ਅਤੇ ਉਹਦੇ ਨਾਲ ਕੀ ਸੀਗਾ ਕਿ ਈਵਨ ਜਿਹੜੇ ਮਹਾਤਮਾ ਗਾਂਧੀ ਸੀ ਉਹਨਾਂ ਦੇ ਬਾਰੇ ਵੀ ਸਾਰਾ ਦੱਸਿਆ ਹੋਇਆ ਸੀਗਾ ਕਿ ਉਹਨਾਂ ਨੂੰ ਨੱਥੂ ਰਾਮ ਗੋਡਸੇ ਨੇ ਜਿਹੜੇ ਸੀਗੇ ਉਹ ਕਿਵੇਂ ਕਤਲ ਕੀਤਾ